ਹਾਂ ਇੱਕ ਇੱਕ ਵਾਰੀ ਮੇਰੇ ਦਿਲਚਸਪੀ ਨਾਲ ਜੁੜੀ ਹੋਈ ਮਜ਼ੇਦਾਰ ਸਾਂਝੀ ਯਾਦ ਹੈ ਕਿ ਇੱਕ ਵਾਰੀ ਸਾਡੇ ਇੱਥੇ ਬਾਸਕਟਬਾਲ ਦਾ ਮੈਚ ਹੋ ਰਿਹਾ ਸੀ ਅਤੇ ਵਿਰੋਧੀ ਟੀਮ ਅਤੇ ਸਾਡੀ ਦੋਵੇਂ ਟੀਮਾਂ ਬਹੁਤ ਪੂਰੇ ਜਬਰਦਸਤ ਮੈਚ ਦੇ ਮੁਕਾਬਲੇ ਨਾਲ ਪੂਰੇ ਸਕੋਰ ਨਾਲ ਬਰਾਬਰ ਬਰਾਬਰ ਜਾ ਰਹੀਆਂ ਸੀ ਅਤੇ ਹੋਇਆ ਇੰਝ ਕਿ ਜਦੋਂ ਹਾਫ਼ ਟਾਈਮ ਹੋਇਆ ਹਾਫ਼ ਟਾਈਮ ਬਾਅਦ ਜੋ ਉਹਨਾਂ ਦੇ ਪਾਸੇ ਬਦਲਣੇ ਸੀਗੇ ਉਹ ਇੱਕ ਇੱਕ ਬੱਚਾ ਨੂੰ ਇਹ ਨਹੀਂ ਪਤਾ ਲੱਗਿਆ ਹੈਗਾ ਵੀ ਮੈਂ ਹੁਣ ਪਾਸਾ ਚੇਂਜ ਕਰਕੇ ਦੂਸਰੀ ਸਾਈਡ ਵੱਗ ਗਿਆ ਉਹ ਉਸ ਟਾਈਮ ਉਸਦੇ ਸਾਰੀ ਟੀਮ ਦੂਸਰੇ ਪਾਸੇ ਫਿਰੇ ਅਤੇ ਉਸਦੇ ਕੋਲ ਬਾਲ ਆ ਗਈ ਉਹ ਬਾਲ ਲੈ ਕੇ ਵਿਰੋਧੀ ਟੀਮ ਦੇ ਗੋਲ ਵੱਲ ਹੀ ਚੱਲ ਚੱਲ ਪਿਆ ਸਾਰੇ ਖਿਡਾਰੀ ਰੌਲਾ ਪਾਈ ਜਾਣ ਵੀ ਤੁਹਾਡੀ ਇੱਧਰ ਹੈ ਗੇ ਗੇਮ ਤੁਹਾਡਾ ਗਰਾਊਂਡ ਉਹਦਾ ਉੱਧਰ ਹੈਗਾ ਤੁਹਾਡਾ ਵੀ ਚੈਕ ਤੁਸੀਂ ਇੱਧਰ ਨਹੀਂ ਇੱਧਰ ਨਹੀਂ ਪਾਉਣੀ ਪਰ ਉਹ ਬੱਚੇ ਨੇ ਕਿਸੇ ਦੀ ਵੀ ਨਹੀਂ ਸੁਣੀ ਹੈਗੀ ਜਾ ਕੇ ਉਹ ਵਿਰੋਧੀ ਟੀਮ ਦੇ ਗੋ ਗੋਲ 'ਚ ਗੋਲ ਕਰ ਆਇਆ ਜੋ ਕਿ ਉਹਨਾਂ ਦੇ ਅਕਾਊਂਟ 'ਚ ਹੋ ਗਿਆ ਬਾਅਦ 'ਚ ਉਸ ਨੂੰ ਵੀ ਪਛਤਾਵਾ ਹੋਵੇ ਵੀ ਮੈਂ ਕੀ ਮੈਂ ਕੀ ਕਰ ਲਿਆ ਇਹ ਮੇਰੇ ਕਹਾਣ ਨੇ ਅੱਜ ਵੀ ਯਾਦ ਹੈ ਜਦੋਂ ਉਹਨੂੰ ਤਾਜ਼ਾ ਕਰਦਾ ਤਾਂ ਇਹ ਮਜ਼ੇਦਾਰ ਯਾਦ ਬਣ ਕੇ ਇੱਕ ਮੇਰੀ ਯਾਦਦਾਸ਼ਤ ਚਸਤ ਘੁੰਮਦੀ ਹੈ ਇਹ ਬਹੁਤ ਹੀ ਮਜ਼ੇਦਾਰ ਮੈਨੂੰ ਲੱਗਣ ਲੱਗ ਰਹੀ ਹੈ